ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਤੁਹਾਡੀ ਕੰਪਨੀ ਤੋਂ ਇੱਕ ਫੋਨ ਮੰਗਵਾਇਆ ਸੀ ਜੀ ਜੋ ਕਿ ਮੈਨੂੰ ਹਾਲ ਵਿੱਚ ਹੀ ਅੱਜ ਜੋ ਹੈ ਮੈਨੂੰ ਡਲੀਵਰ ਹੋਇਆ ਏ ਜੋ ਕਿ ਮੈਂ ਮੰਗਵਾਇਆ ਇੱਕ ਮੰਥ ਪਹਿਲਾਂ ਸੀ ਅਤੇ ਜਦੋਂ ਮੈਂ ਇਸਨੂੰ ਓਪਨ ਕਰਿਆ ਤਾਂ ਇਸ ਦੇ ਉੱਪਰ ਬਹੁਤ ਸਾਰੇ ਸਕਰੈਚ ਸਨ ਅਤੇ ਇਹ ਪੂਰਾ ਇਹ ਵਰਕ ਵੀ ਨਹੀਂ ਕਰ ਰਿਹਾ ਸੀ ਅਤੇ ਨ ਜਦੋਂ ਮੈਂ ਇਹਨੂੰ ਮੰਨ ਲਓ ਇੱਕ ਵਾਰ ਚਲਵਾਇਆ ਤਾਂ ਇਹਦੇ ਜੋ ਹੈ ਇਹ ਬਾਰ ਬਾਰ ਹੈਂਗ ਹੋ ਰਿਹਾ ਸੀ ਅਤੇ ਇਹਨੂੰ ਚਾਰਜ ਵੀ ਪ੍ਰੋਪਰ ਨਹੀਂ ਹੋ ਰਿਹਾ ਸੀ ਇਹ ਇਸ ਲਈ ਮੈਨੂੰ ਇਹ ਤੁਹਾਡਾ ਪ੍ਰੋਡਕਟ ਬਹੁਤਾ ਚੰਗਾ ਨਹੀਂ ਲੱਗਿਆ ਅਤੇ ਨਾ ਇਹ ਮੇਰੇ ਦੋਸਤ ਇਸ ਬਾਰੇ ਬਹੁਤ ਪੁੱਛ ਰਹੇ ਸਨ ਤਾਂ ਮੈਂ ਉਹਨਾਂ ਉਹਨਾਂ ਨੂੰ ਦੱਸਿਆ ਕਿ ਇਹ ਬਹੁ ਪ੍ਰੋਡਕਟ ਬਹੁਤ ਚੰਗਾ ਨਹੀਂ ਹੈ